ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਤੁਸੀਂ ਪਰਸੋ ਤੁਸੀਂ ਪਰਸੋਂ ਆਏ ਸੀ ਹਾਂਜੀ ਹਾਂਜੀ ਜਿੱਦਾਂ ਤੁਸੀਂ ਬਜਟ ਦੱਸਿਆ ਸੀ ਆਪਣਾ ਕਿ ਸਾਡਾ ਇੰਨਾ ਕੁ ਬਜਟ ਆ ਉਸਦੇ ਹਿਸਾਬ ਦੇ ਨਾਲ ਸਾਡੇ ਕੋਲ ਤਿੰਨ ਤੋਂ ਚਾਰ ਘਰ ਨੇ ਅਤੇ ਉਹਨਾਂ ਵਿੱਚੋਂ ਦੋ ਦੀਆਂ ਸਾਡੇ ਕੋਲ ਚਾਬੀਆਂ ਹੈਗੀਆਂ ਅਤੇ ਦੋ ਦੀਆਂ ਨਹੀਂ ਹੈਗੀਆਂ ਅਤੇ ਦੋ ਘਰ ਆ ਤੁਸੀਂ ਆ ਕੇ ਦੇਖ ਸਕਦੇ ਹੋ ਜਿੰਨਾ ਕੁ ਤੁਹਾਡਾ ਬਜਟ ਹੈ ਉਸ ਦੇ ਹਿਸਾਬ ਨਾਲ ਓਕੇ ਅੱਛਾ ਜੀ ਹਾਂਜੀ ਹਾਂਜੀ ਤੁਹਾਡੇ ਨਜ਼ਦੀਕ ਹੀ ਹੈ ਗਰੀਨ ਵੈਲੀ ਐਕਸਟੈਂਸ਼ਨ ਕਲੋਨੀ ਆ ਬਹੁਤ ਸੋਹਣੀ ਬਣੀ ਹੋਈ ਹੈ ਵਿੱਚ ਪਾਰਕ ਵੀ ਹੈ ਬੱਚਿਆਂ ਦੀ ਖੇਡਣ ਨੂੰ ਅਤੇ ਉਸਦੇ ਵਿੱਚ ਬਹੁਤ ਸੋਹਣਾ ਘਰ ਬਣਿਆ ਹੋਇਆ ਹਾਂਜੀ ਉਸ

ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਦੇਖੋ ਜਿਹੜੇ ਹੈਗੇ ਆ ਇਹਦੇ ਵਿੱਚ ਗਰੀਨ ਵੈਲੀ ਐਕਸਟੈਨਸ਼ਨ ਦੇ ਵਿੱਚ ਦੋ ਘਰ ਹੈ ਉਹ ਇੱਕ ਤਾਂ ਹੈਗਾ ਤਿੰਨ ਬਿਲਡਿੰਗ ਹੈ ਅਤੇ ਜਿਹਦੇ ਵਿੱਚ ਹੈ ਨਾ ਤਿੰਨ ਮੰਜ਼ਿਲ ਆ ਇੱਕ 'ਚ ਹੈਗਾ ਦੋ ਮੰਜ਼ਿਲ ਠੀਕ ਹੈ ਜਿਹੜਾ ਦੋ ਮੰਜ਼ਿਲ ਹੈ ਉਹਦੇ ਵਿੱਚ ਤਾਂ ਨੀਚੇ ਤਿੰਨ ਕਮਰੇ ਬਣੇ ਹੋਏ ਆ ਪਲਸ ਓਪਨ ਜਿਹੜਾ ਰਸੋਈ ਬਣੀ ਹੋਈ ਰਸੋਈ ਘਰ ਬਣਿਆ ਹੋਇਆ ਹੈਗਾ ਅਤੇ ਉੱਪਰ ਹੈ ਜਿਹੜਾ ਉੱਪਰ ਜੀ ਉਹਨਾਂ ਨੇ ਦੋ ਕਮਰੇ ਪਾਏ ਹੋਏ ਆ ਤੇ ਅਤੇ ਵਿੱਚੇ ਉਹਨਾਂ ਦੇ ਵਾਸ਼ਰੂਮ ਵਗੈਰਾ ਅਤੇ ਸਾਰਾ ਕੁਛ ਬਣਿਆ ਅਤੇ ਉੱਪਰ ਆ ਜਿਹੜੇ ਕਿਚਨ ਦੇ ਨਾਲ ਨਾਲ ਸਟੋਰ ਰੂਮ ਵੀ ਹੈ ਉੱਪਰਲੇ ਪਾਸੇ ਅਤੇ ਜਿਹੜਾ ਉੱਪਰ ਹੈ ਲਾਸਟ ਵਾਲੀ ਆ ਉਹ ਓਪਨ ਓਪਨ ਹੀ ਜਿਹੜੀ ਛੱਤ ਟੈਰਿਸ ਹੈ ਅਤੇ ਜਿਹੜਾ ਦੂਸਰਾ ਘਰ ਹੈ ਹਾਂਜੀ ਉਹ ਦੂਸਰਾ ਘਰ ਉਹ ਹੈਗਾ ਇੱਕ ਮੰਜ਼ਿਲ ਹੀ ਆ ਉਹਦੇ ਵਿੱਚ ਬਸ ਨੀਚੇ ਪੋਸ਼ਣ ਬਣਿਆ ਉੱਪਰ ਸਿੰਗਲ ਹੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਿਹੜਾ ਤੁਸੀਂ ਮੈਂ ਤੁਹਾਨੂੰ ਇੱਕ ਮੰਜ਼ਿਲ ਵਾਲਾ ਦੱਸਿਆ ਉਹਦੇ ਨੀਚੇ ਸਟੋਰ ਰੂਮ ਵੀ ਹੈਗਾ ਗਾ ਅਤੇ ਉਹਦੇ 'ਚ ਤੁਹਾਨੂੰ ਸਹੀ ਰਹੇਗਾ ਵੀ ਜਿਸ ਹਿਸਾਬ ਨਾਲ ਤੁਹਾਡੀ ਫੈਮਲੀ ਹੈਗੀ ਹੈ ਜੀ ਛੋਟੀ ਜਿਹੀ ਉਸ ਹਿਸਾਬ ਨਾਲ ਤੁਹਾਨੂੰ ਉਹ ਵੀ ਸੈਟ ਬੈਠੂਗਾ ਨਾਲ ਬਜਟ 'ਚ ਤੁਹਾਡੇ ਇਹ ਤੁਹਾਨੂੰ ਫਿਰ ਵੀ ਮਿਲ ਜਾਵੇਗਾ ਇਹ ਮਿਲ ਜੂਗਾ ਤੁਹਾਨੂੰ ਸਾਢੇ ਕੁ ਪੰਜ ਲੱਖ ਰੁਪਏ ਦਾ ਹਿਸਾਬ ਨਾਲ ਮਿਲ ਜੂਗਾ ਨਹੀਂ ਨਹੀਂ ਅਨਕੰਪਲੀਟ ਨਹੀਂ ਕੰ ਨਹੀਂ ਨਹੀਂ ਤੁਹਾਨੂੰ ਫਰਨੀਚਰ ਤਾਂ ਥੋੜ੍ਹਾ ਜਿਹਾ ਕੰਮ ਕਰਵਾਉਣਾ ਪਵੇਗਾ ਬਾਕੀ ਸਾਰਾ ਤਿਆਰ ਹੈ ਕਲਰ ਵਗੈਰਾ ਕੀਤਾ ਹੋਇਆ ਪੇਂਟ ਵਗੈਰਾ ਫਰਨੀਚਰ ਥੋੜ੍ਹਾ ਕੰਮ ਕਰਵਾਉਣਾ ਹੋਊ ਹਾਂਜੀ ਹਾਂਜੀ ਉਹ ਬਣਵਾਉਣਾ ਪਵੇਗਾ ਹਾਂਜੀ ਸਾਢੇ ਪੰਜ ਲੱਖ ਜਿਹੜਾ ਦੂ ਜਿਹੜਾ ਜਮਾਂ ਤਿਆਰ ਹੈ ਸਾਰਾ ਉਹ ਤੁਹਾਨੂੰ ਪਵੇਗਾ ਘੱਟੋ ਘੱਟ ਚੋਦਾਂ ਪੰਦਰਾਂ ਲੱਖ ਰੁਪਏ ਦਾ ਉਹ ਸਾਰਾ ਤਿਆਰ ਉਹਦੇ 'ਚ ਤਿੰਨ ਮੰਜ਼ਿਲ ਹੋ ਗਿਆ ਸਾਰਾ ਵਿੱਚ ਫਰਨੀਚਰ ਦਾ ਕੰਮ ਹੈ ਪਲਸ ਉਹ ਬੈਡ ਵੀ ਵਿੱਚ ਹੀ ਦੇ ਰਿਹਾ ਆਪਣੇ ਕਿਉਂਕਿ ਬਣੇ ਹੋਏ ਨਾ ਵਿੱਚ ਹੀ ਉਹ ਤਾਂ ਕੁਝ ਵਿਚ ਹੀ ਆ ਉਹਦੇ ਵਿੱਚ ਤਾਂ ਉਹ ਤਾਂ ਤਿੰਨ ਮੰਜ਼ਿਲਾ ਉਹ ਤੁਹਾਨੂੰ ਇੰਨੇ ਕੁ ਦਾ ਪਵੇਗਾ ਹਾਂਜੀ ਦੇਖ ਕੇ ਬਾਕੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਹੈਗਾ ਬਾਬਾ ਫਰੀਦ ਸਾਈਡ ਜੋ ਹੈਗਾ ਉਸ ਮੈਂ ਤੁਹਾਨੂੰ ਦੱਸਿਆ ਨਾ ਚਾਰ ਘਰ ਆ ਜਿਹੜੇ ਤੁਹਾਡੇ ਬਜਟ ਦੇ ਅੰਦਰ ਹੈ ਉਹ ਦੋ ਘਰ ਉੱਧਰ ਉਹਨਾਂ ਦੇ ਹਜੇ ਆਪਣੇ ਕੋਲ ਚਾਬੀਆਂ ਨਹੀਂ ਆਈਆਂ ਜਦੋਂ ਚਾਬੀਆਂ ਆ ਜਾਣਗੀਆਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਪਹਿਲਾਂ ਤੁਸੀਂ ਇਹ ਦੇਖ ਜਾਓ ਆਪਣੇ ਘਰ ਵਾਲੇ ਨਾਲ ਆ ਕੇ ਜਾਂ ਬੱਚਿਆਂ ਨਾਲ ਆ ਕੇ ਪਹਿਲਾਂ ਤੁਸੀਂ ਇਹਨੂੰ ਦੇਖ ਜਾਓ ਤੁਹਾਨੂੰ ਇਹ ਸੈਟਿੰਗ ਤੁਹਾਡੇ ਇਹਦੇ ਨਾਲ ਕਰਾ ਲਾਂਗੇ ਤਾਂ ਅਗਰ ਜੇ ਤੁਹਾਡੇ ਕੋਲ ਪੇਮੈਂਟ ਵਗੈਰਾ ਨਹੀਂ ਹੈਗੀ ਇਕੱਠੀ ਤਾਂ ਜੇ ਤੁਸੀਂ ਰਿਟਰਨਾ ਕਰਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਜੇ ਅਗਰ ਹਾਂਜੀ ਹਾਂਜੀ ਮੈਂ ਕਹਿੰਦੀ ਜੇ ਅਗਰ ਜੇ ਤੁਹਾਡੇ ਬਜਟ ਵਗੈਰਾ ਤੁਹਾਨੂੰ ਲੱਗਦਾ ਤਾਂ ਮੈਂ ਕਿਹਾ ਜੇ ਤੁਸੀਂ ਰਿਟਰਨਾ ਭਰ ਤੁਹਾਡਾ ਲੋਨ ਹੋ ਜਾਵੇਗਾ ਹਾਂਜੀ ਹਾਂਜੀ ਹਾਂਜੀ ਇੱਕ ਵਾਰ ਬਣਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਪਾਣੀ ਨਹੀਂ ਵੜਦਾ ਵਧੀਆ ਬਣੀ ਹੋਈ ਹੈ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਬਹੁਤ ਸੋਹਣਾ ਹਾਂਜੀ ਹਾਂਜੀ ਨਹੀਂ ਵੀ ਬਹੁਤ ਵਧੀਆ ਬਣਿਆ ਹੋਇਆ ਓਕੇ ਜੀ ਕੋਈ ਗੱਲ ਨਹੀਂ ਤੁਸੀਂ ਆ ਕੇ ਇੱਕ ਵਾਰ ਮਿਲ ਲਿਓ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ